ਫ਼ਾਜ਼ਿਲਕਾ ਸ਼ਹਿਰ ਸਭ ਤੋਂ ਜ਼ਿਆਦਾ ਖੇਤੀਬਾੜੀ 'ਤੇ ਹੀ ਡਿਪੈਂਡ ਹੈ ਕਿਉਂਕਿ ਇੱਥੇ ਕੋਈ ਵੱਡੇ ਉਦਯੋਗ ਨਹੀਂ ਹਨ ਅਤੇ ਰੁਜ਼ਗਾਰ ਦਾ ਸਾਧਨ ਹੋਰ ਨਹੀਂ ਹੈ ਕੋਈ ਰੁਜ਼ਗਾਰ ਵਾਸਤੇ ਲੋਕ ਸਰਕਾਰੀ ਨੌਕਰੀਆਂ ਵੱਲ ਜਾਂ ਪ੍ਰਾਈਵੇਟ ਨੌਕਰੀਆਂ ਵੱਲ ਜ ਜਾ ਰਹੇ ਨੇ ਜਿਹੜੀਆਂ ਕਿ ਮਿਲਦੀਆਂ ਬਹੁਤ ਮੁਸ਼ਕਿਲ ਨੇ ਇਹਦਾ ਹੱਲ ਹੈ ਵੀ ਸਰਕਾਰ ਨੂੰ ਕੋਈ ਰੁਜ਼ਗਾਰ ਦੇ ਤਰੀਕੇ ਨਿਕਾਲਣੇ ਚਾਹੀਦੇ ਹਨ ਜਿਸ ਦੇ ਨਾਲ ਪਬਲਿਕ ਬੱਚੇ ਆਪਣੇ ਰੁਜ਼ਗਾਰ 'ਚ ਲੱਗ ਜਾਣ ਅਤੇ ਆਪਣੇ ਪ ਪਰਿਵਾਰ ਨੂੰ ਪਾਲ ਸਕਣ